ਤੇਈ ਅਕਤੂਬਰ ਉੱਨੀ ਸੌ ਛਿਆਨਵੇਂ ਅਠਾਈ ਜੁਲਾਈ ਉੱਨੀ ਸੌ ਨੱਬੇ ਪੱਚੀ ਜੁਲਾਈ ਉੱਨੀ ਸੌ ਪੈਂਹਠ ਸੋਲ੍ਹਾਂ ਦਸੰਬਰ ਉੱਨੀ ਸੌ ਠਾਹਠ ਅੱਠ ਦਸੰਬਰ ਉੱਨੀ ਸੌ ਬਾਨਵੇਂ